ਵੈਸੇ ਤਾਂ ਪਿੰਡਾਂ ਵਾਲਿਆਂ ਨੂੰ ਭਾਰ ਵਧਾਉਣ ਦੀ ਲੋੜ ਹੀ ਨਹੀਂ ਹੈ ਉਹਨਾਂ ਦਾ ਵਜ਼ਨ ਪਹਿਲਾਂ ਹੀ ਸਹੀ ਰਹਿੰਦਾ ਹੈ ਇਹ ਤਾਂ ਸ਼ਹਿਰੀ ਲੋਕਾਂ ਨੂੰ ਭਾਰ ਵਧਾਉਣ ਦੀ ਲੋੜ ਹੁੰਦੀ ਹੈ ਅਗਰ ਫਿਰ ਵੀ ਕਿਸੇ ਨੇ ਵਧਾਉਣਾ ਹੈ ਤਾਂ ਇਸ ਲਈ ਦੁੱਧ ਦਹੀਂ ਲੱਸੀ ਆਲੂ ਆਦਿ ਖਾਣ ਨਾਲ ਭਾਰ ਵੱਧ ਜਾਂਦਾ ਹੈ ਔਰ ਇਸ ਤੋਂ ਇਲਾਵਾ ਪਨ ਪਨੀਰੀ ਪੰਜੀਰੀ ਆਦਿ ਖਾਣ ਨਾਲ ਵੀ ਭਾਰ ਵੱਧਦਾ ਹੈ ਔਰ ਪਿੰਨੀਆਂ ਆਦਿ ਖਾਣ ਨਾਲ ਵੀ ਭਾਰ ਵੱਧ ਜਾਂਦਾ ਹੈ ਪਿੰਨੀਆਂ ਬਣਾਉਣ ਵਾਸਤੇ ਉਸ ਵਿੱਚ ਬਦਾਮ ਕਾਜੂ ਆਦਿ ਪਾਉਣ ਨਾਲ ਵੀ ਬੰਦੇ ਦਾ ਭਾਰ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਗਜਰੇਲਾ ਗਰਮ ਮ ਖਾਣ ਨਾਲ ਵੀ ਬੰਦੇ ਦਾ ਭਾਰ ਕਾਫ਼ੀ ਵੱਧ ਜਾਂਦਾ ਹੈ